ਨਮਸਕਾਰ ਮੈਂ ਪਾਇਲ ਗਲੀ ਨੰਬਰ ਅੱਠ ਸ਼ਹਿਰ ਫ਼ਾਜ਼ਿਲਕਾ ਤੋਂ ਗੱਲ ਕਰ ਰਹੀ ਹਾਂ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਸਾਡੇ ਮੁਹੱਲੇ ਵਿੱਚ ਬਹੁਤ ਜ਼ਿਆਦਾ ਕੂੜਾ ਕਰਕਟ ਫੈਲਿਆ ਹੋਇਆ ਹੈ ਜਿਸ ਕਰਕੇ ਇੰਨੀ ਗੰਦਗੀ ਵੱਧ ਚੁੱਕੀ ਹੈ ਅਤੇ ਮੱਛਰ ਅਤੇ ਬਿਮਾਰੀਆਂ ਇੰਨੀਆਂ ਹੋ ਚੁੱਕੀਆਂ ਹਨ ਕਿ ਇੱਥੇ ਖੜਾ ਹੋਣਾ ਵੀ ਬਹੁਤ ਮੁਸ਼ਕਿਲ ਹੈ ਬਹੁਤ ਜ਼ਿਆਦਾ ਬਦਬੂ ਆਉਣ ਕਰਕੇ ਘਰਾਂ ਦੇ ਵਿੱਚ ਵੀ ਬਹੁਤ ਮੁਸ਼ਕਿਲ ਨਾਲ ਰਹਿਣਾ ਪੈ ਰਿਹਾ ਹੈ ਅਤੇ ਇਸ ਕਰਕੇ ਬਿਮਾਰੀਆਂ ਵੀ ਵੱਧ ਰਹੀਆਂ ਹਨ ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਡੇਂਗੂ ਕਿੰਨਾ ਫੈਲ ਰਿਹਾ ਹੈ ਅਤੇ ਇਸ ਕੂੜੇ ਕਰਕਟ ਕਰਕੇ ਹੋਰ ਜ਼ਿਆਦਾ ਫੈਲ ਰਿਹਾ ਹੈ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਜਲਦ ਤੋਂ ਜਲਦ ਜਿੰਨਾ ਹੋ ਸਕੇ ਮੁਹੱਲੇ ਦੀ ਸਾਫ਼ ਸਫਾਈ ਕਰਵਾ ਦਿਓ ਤਾਂ ਕਿ ਸਾਨੂੰ ਇੱਥੇ ਆਸਾਨੀ ਨਾਲ ਰੈ ਰਿਹਾ ਜਾ ਸਕੇ ਤਾਂ ਜੋ ਬਿਮਾਰੀਆਂ ਵੀ ਘੱਟ ਜਾਣ ਤੁਸੀਂ ਜਲਦ ਤੋਂ ਜਲਦ ਇਹਦੇ 'ਤੇ ਐਕਸ਼ਨ ਲੈ ਲਓ ਧੰਨਵਾਦ